ਮੈਂ ਆਪਣੇ ਬਾਗਬਾਨੀ ਵਿੱਚ ਸੁਧਾਰ ਦੇ ਸੰਦਾ ਲਈ ਇਸਤੇਮਾਲ ਕਰਦਾ ਜਿਵੇਂ ਕਿ ਕਹੀ ਹੋ ਗਈ ਰੰਬੀ ਹੋ ਗਈ ਦਾਤਰੀ ਹੋ ਗਈ ਹੋਰ ਫੁਵਾਰੇ ਵਗੈਰਾ ਸਪਰੇ ਵਗੈਰਾ ਕਰਨ ਵਾਲੇ ਪੰਪ ਇਹਨਾਂ ਦਾ ਇਸਤੇਮਾਲ ਕਰਦਾ ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਔਰ ਇਸ ਤੋਂ ਓ ਓ ਓ ਕਹੀ ਕਹੀ ਨਾਲ ਮਿੱਟੀ ਪੁੱਟ ਕੇ ਗੋਡੀ ਵਗੈਰਾ ਕਰ ਲਈ ਦੀ ਆ ਬਾਗਬਾਨੀ ਵਿੱਚ ਔਰ ਨਾਲੇ ਵਗੈਰਾ ਕਹੀ ਨਾ ਬਣਾ ਲਈ ਦੇ ਆ ਰੰਬੀ ਨਾਲ ਵੀ ਅਸੀਂ ਗੋਡੀ ਪਾਲਦੇ ਆ ਕਹੀ ਨਾਲ ਬਾਗਬਾਨੀ 'ਚ ਜਿਹੜੇ ਬੂਟੇ ਲਗਾਏ ਹੁੰਦੇ ਆ ਉਹਨਾਂ ਉੱਤੇ ਮਿੱਟੀ ਮੁੱਟੀ ਪਾ ਲੈਂਦੇ ਹਾਂ ਗੇਤੀ ਵਗੈਰਾ ਵੀ ਰੱਖਦੇ ਨੇ ਜਿਹਦੇ ਨਾਲ ਅਸੀਂ ਖੁਦਾਈ ਖੁਦਾਈ ਵਗੈਰਾ ਕਰ ਸਕੀਏ